ਹਾਂਜੀ ਪਿਛਲੇ ਸਮੇਂ ਦੀ ਜੇ ਅਸੀਂ ਗੱਲ ਕਰੀਏ ਤਾਂ ਪਿਛਲੇ ਸਮੇਂ ਵਿੱਚ ਲੋਕਾਂ ਦਾ ਵਾਤਾਵਰਣ ਬੋਲੀ ਬਾਣੀ ਹਰ ਚੀਜ਼ ਵਿੱਚ ਬੜਾ ਵੀ ਇੱਕ ਅਨੁਭਵ ਬੜਾ ਚੰਗਾ ਸੀ ਪਰ ਅੱਜ ਕੱਲ ਦੇ ਸਮੇਂ ਵਿੱਚ ਜਿਹੜਾ ਵੀ ਅਨੁਭਵ ਹੈ ਲੋਕਾਂ ਦਾ ਜਾਂ ਲੋਕਾਂ ਦੀ ਬੋਲੀ ਬਾਣੀ ਹੈ ਬਹੁਤ ਵੱਖਰੇ ਪ੍ਰਕਾਰ ਦੀ ਹੈ ਲੋਕਾਂ ਦਾ ਹਰ ਚੀਜ਼ ਵਿੱਚ ਵੱਖਰਾ ਹੀ ਵਾਤਾਵਰਣ ਹੈ ਖਾਣ ਪੀਣ ਵਿੱਚ ਬੋਲੀ ਬਾਣੀ ਵਿੱਚ ਲੋਕਾਂ ਦੇ ਰਹਿਣ ਸਹਿਣ ਦਾ ਢੰਗ ਬਹੁਤ ਬਦਲ ਚੁੱਕਿਆ ਪਹਿਲੇ ਲੋਕ ਇਕੱਠੇ ਰਹਿੰਦੇ ਸੀ ਗੱਲਬਾਤ ਕਰਦੇ ਸੀ ਆਪਣਾ ਮਤਲਬ ਕਿ ਹਰ ਇੱਕ ਦੁੱਖ ਸੁੱਖ ਕਰਦੇ ਸੀ ਪਰ ਅੱਜ ਕੱਲ ਦੇ ਸਮੇਂ ਵਿੱਚ ਕਿਸੀ ਕੋਲ ਇੰਨਾ ਟਾਈਮ ਹੀ ਨਹੀਂ ਹੈ ਕਿ ਕੋਈ ਕਿਸੇ ਕੋਲ ਬੈਠ ਕੇ ਉਹਦੀ ਕੋਈ ਗੱਲ ਸਮਝ ਸਕੇ ਜਾਂ ਉਹਨੂੰ ਕੋਈ ਸੁਣ ਸਕੇ ਪਿਛਲੇ ਸਮੇਂ 'ਚ ਅਸੀਂ ਕਹਿੰਦੇ ਹਾਂ ਕਿ ਜਿਵੇਂ ਅਸੀਂ ਕੋਈ ਖੇਡਾਂ ਖੇਡਦੇ ਸੀ ਅਸੀਂ ਹਰ ਚੀਜ਼ ਇਕੱਠੇ ਬੈਠ ਕੇ ਕਰਦੇ ਸੀ ਖਾਂਦੇ ਸੀ ਪੀਂਦੇ ਸੀ ਪਰ ਅੱਜ ਕੱਲ ਦੇ ਸਮੇਂ ਵਿੱਚ ਉਹ ਚੀਜ਼ਾਂ ਸਭ ਖਤਮ ਹੋ ਚੁੱਕੀਆਂ ਨੇ ਹਰ ਇੱਕ ਦਾ ਵਾਤਾ ਨੇਚਰ ਹਰ ਇੱਕ ਦਾ ਸੁਭਾਅ ਇੱਕ ਕੁਝ ਅਲੱਗ ਹੀ ਪ੍ਰਕਾਰ ਦਾ ਹੋ ਰਿਹਾ ਹੈ ਅੱਜ ਕੱਲ ਤਾਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਕਿ ਲੋਕਾਂ ਵਿੱਚ ਗੁੱਸਾ ਬਹੁਤ ਆ ਰਿਹਾ ਜਿਸ ਕਰਕੇ ਕਈਆਂ ਲੋਕਾਂ ਨੂੰ ਹਾਣੀ ਵੀ ਹੋ ਰਹੀ ਹੈ ਅਤੇ ਜੋ ਪਿਛਲਾ ਸਮੇਂ ਸੀ ਪਿਛਲੇ ਸਮੇਂ ਵਿੱਚ ਲੋਕਾਂ ਵਿੱਚ ਪ੍ਰੇਮ ਭਾਵ ਦੀ ਭਾਵਨਾ ਬਹੁਤ ਜ਼ਿਆਦਾ ਸੀ ਇਸ ਕਰਕੇ ਪਿਛਲੇ ਸਮੇਂ ਦੀਆਂ ਖੇਡਾਂ ਜਿਹੜੀਆਂ ਸਨ ਉਹ ਬੜੀ ਚੰਗੀਆਂ ਸੀ ਅਸੀਂ ਬੱਚੇ ਬਣ ਕੇ ਬੱਚਿਆਂ ਨਾਲ ਖੇਡਦੇ ਸੀ ਅਸੀਂ ਖੋ ਖੋ ਖੇਡ ਲੈਣੀ ਸੀ ਲੁੱਕਣ ਮਿੱਟੀ ਐ ਇਹ ਖੇਡਾਂ ਜਿਹੜੀ ਸੀ ਪਿਛਲੇ ਸਮੇਂ ਦੀਆਂ ਬਹੁਤ ਪ੍ਰਭਾਵਿਤ ਕਰਦੀਆਂ ਇਸ ਸਮੇਂ ਵਿੱਚ ਸਾਨੂੰ ਜਦੋਂ ਇਹ ਚੀਜ਼ਾਂ ਯਾਦ ਆਉਂਦੀਆਂ ਨੇ ਤਾਂ ਸਾਨੂੰ ਅੱਜ ਦੇ ਸਮੇਂ ਥੋੜ੍ਹਾ ਜਿਹਾ ਉਸ ਪ੍ਰਕਾਰ ਨਾਲ ਚੰਗਾ ਨਹੀਂ ਲੱਗਦਾ ਇਸ ਕਰਕੇ